ਸਭ ਤੋਂ ਅਣਕਿਆਸੀ ਘਟਨਾ ਜਿਹੜੀ ਮੇਰੇ ਨਾਲ ਹੋਈ ਸੀ ਚੀਜ਼ ਉਹ ਇਹ ਸੀ ਕਿ ਮੈਂ ਕਿਸੇ ਰੈਂਸਟੋਰੈਟ ਦਾ ਨਾਂ ਬਹੁਤ ਸੁਣਿਆ ਸੀਗਾ ਅਤੇ ਉੱਥੇ ਮੈਂ ਜਾ ਕੇ ਆਪਣੇ ਫਰੈਂਡਸ ਦੇ ਕਹਿਣ 'ਤੇ ਨਾਲ ਗਈ ਉਨ੍ਹਾਂ ਦੇ ਅਤੇ ਔਡਰ ਕੀਤਾ ਅਤੇ ਸਡਨਲੀ ਔਡਰ ਆਉਣ ਤੋਂ ਬਾਅਦ ਜਿਵੇਂ ਹੀ ਚੈੱਕ ਕੀਤਾ ਉਹ ਕਹਿੰਦੇ ਸੀ ਬੜੀ ਸਫ਼ਾਈ ਆ ਬਹੁਤ ਡੈਲੀਕੇਟਿਡ ਨੇ ਬਹੁਤ ਕੁਝ ਹੈ ਅਤੇ ਮੈਂ ਵੇਖਿਆ ਕਿ ਉਹ ਖਾਣੇ ਦੇ ਵਿੱਚ ਕੁਛ ਸੀਗਾ ਕੋਈ ਮੋਸਕੀਟੋ ਟਾਈਪ ਕੁਛ ਅਤੇ ਉਹ ਬੜੀ ਹੀ ਵੇਅਰਡ ਜਿਹਾ ਲੱਗਿਆ ਸੀ ਮੈਨੂੰ ਮੈਂ ਐਂਦਾ ਸੋਚਿਆ ਨਹੀਂ ਸੀਗਾ ਅਤੇ ਉਹ ਚੀਜ਼ ਮੇਰੇ ਨਾਲ ਹੋਈ ਅਤੇ ਉਹ ਮੈਨੂੰ ਬਿਲਕੁਲ ਚੰਗੀ ਨਹੀਂ ਲੱਗੀ ਅਤੇ ਦੂਜੀ ਗੱਲ ਇਹ ਹੈ ਕਿ ਤਸਵੀਰਾਂ ਮੈਂ ਕਲਿੱਕ ਕਰਦੀ ਹਾਂ ਆਪਦੇ ਫਰੈਂਡਸ ਨੂੰ ਕਹਿ ਦਿੰਦੀ ਹਾਂ ਵੀ ਹਾਂ ਕਲਿੱਕ ਕਰ ਦਿਉ ਵੈਸੇ ਮੈਨੂੰ ਇਸ ਚੀਜ਼ ਦਾ ਬਹੁਤਾ ਸ਼ੌਕ ਵੀ ਨਹੀਂ ਹੈ ਜੇ ਪੋਸਟ ਕਰਨੀਆਂ ਹੋਣ ਤਾਂ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੰਦੀ ਹਾਂ ਵਟਸਐੱਪ ਫੇਸਬੁੱਕ ਵਗੈਰਾ 'ਤੇ ਵੈਸੇ ਇਹ ਚੀਜ਼ਾਂ ਮੈਂ ਘੱਟ ਕਰਦੀ ਹਾਂ